ਸਥਾਨਕ ਵਪਾਰਕ ਕੇਂਦਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਆਪਾ ਕਹਿ ਲਈਏ ਵੀ ਮੰਨ ਲਓ ਰੋਪੜ ਦਾ ਵਪਾਰ ਮੰਡਲ ਹੈਗਾ ਹੈ ਵੀ ਹਾਂ ਰੋਪੜ ਦੀਆਂ ਦੁਕਾਨਾਂ ਹੈਗੀਆਂ ਇਹ ਵੀ ਵਪਾਰ ਕੇਂਦਰ ਹੀ ਆ ਇੱਕ ਤਰ੍ਹਾਂ ਦੇ ਤਾਂ ਓਹਦੇ 'ਚ ਜਿਵੇਂ ਮੰਨ ਲਓ ਹੁਣ ਇੱਕ ਦੁਕਾਨ ਹੈ ਕੋਈ ਇਲੈਕਟ੍ਰਾਨਿਕਸ ਦੀ ਹੈ ਜਾਂ ਕਰਿਆਨੇ ਦੀ ਹੈ ਉਹਦੇ ਤੋਂ ਇੱਕ ਚੀਜ਼ ਵਿਕਦੀ ਆ ਉਹ ਵਿਕੀ ਹੋਈ ਚੀਜ਼ ਕਿਸੇ ਦੇ ਘਰ ਪਹੁੰਚਣੀ ਹੈ ਕਿਵੇਂ ਪਹੁੰਚੁਗੀ ਜਿਵੇਂ ਉਹ ਬੰਦਾ ਕੋਈ ਰੇਹੜੀ ਵਾਲਾ ਆਵੇਗਾ ਲੈਣ ਲਈ ਕੋਈ ਟੈਂਪੂ ਵਾਲਾ ਆਵੇਗਾ ਲੈਣ ਲਈ ਇਹਨਾਂ ਚੀਜ਼ਾਂ ਦੇ ਨਾਲ ਉਨ੍ਹਾਂ ਲੋਕਾਂ ਨੂੰ ਅੱਗੇ ਕੰਮ ਮਿਲਦਾ ਤਾਂ ਅੱਗੇ ਦੀ ਅੱਗੇ ਇੱਕ ਸਿਸਟਮ ਬਣਦਾ ਹੈ ਕੜੀ ਬਣਦੀ ਆ ਜਿਹਦੇ 'ਚ ਇੱਕ ਦੂਜੇ ਦੇ ਨਾਲ ਜੁੜ ਕੇ ਕੰਮ ਵੱਧਦਾ ਹੈ ਅਤੇ ਨੇੜੇ ਤੇੜੇ ਦੇ ਲੋਕਾਂ ਨੂੰ ਵੀ ਕੰਮ ਮਿਲਦਾ ਆਲੇ ਦੁਆਲੇ ਦਿਆਂ ਨੂੰ ਜਿਹਦੇ ਕਰਕੇ ਉਨ੍ਹਾਂ ਦਾ ਆਪਣਾ ਇੱਕ ਜੀਵਨ ਵੀ ਸੌਖਾ ਹੋ ਜਾਂਦਾ ਹੈ ਥੋੜ੍ਹਾ ਜਿਹਨੂੰ ਕਹਿੰਦੇ ਹੁੰਦੇ ਆ ਹੈਲਪ ਹੋ ਜਾਣੀ ਇੱਕ ਦੂਜੇ ਦੀ ਮਦਦ ਕਰਨਾ